ਮੈਂ ਆਪਣੇ ਇਲਾਕੇ ਵਿੱਚ ਇੱਕ ਕਲੱਬ ਨੂੰ ਜੁਆਇਨ ਕੀਤਾ ਸੀ ਜੋ ਕਿ ਦੌੜ ਲਗਾਉਣ ਲਈ ਜਾਂਦੇ ਸੀ ਸਵੇਰੇ ਜਲਦੀ ਉੱਠ ਕੇ ਅਤੇ ਸਵੇਰੇ ਜਲਦੀ ਉੱਠਣ ਦੇ ਵੀ ਕਾਫ਼ੀ ਫ਼ਾਇਦੇ ਹੁੰਦੇ ਨੇ ਵਾਤਾਵਰਨ ਕਾਫ਼ੀ ਸ਼ੁੱਧ ਹੁੰਦਾ ਹੈ ਅਤੇ ਹਵਾ ਵੀ ਕਾਫ਼ੀ ਤਾਜ਼ੀ ਚਲਦੀ ਹੈ ਵਾਤਾਵਰਣ ਵਿੱਚ ਕਾਫ਼ੀ ਸਾਨੂੰ ਦੇਖਣੇ ਨੂੰ ਮਿਲਦਾ ਅਨੁਭਵ ਕਰਦੇ ਹਾਂ ਕਿ ਸਵੇਰੇ ਉਠਦੇ ਹਾਂ ਜਦੋਂ ਉਦੋਂ ਕੋਈ ਪ੍ਰਦੂਸ਼ਣ ਵੀ ਨਹੀਂ ਹੁੰਦਾ ਹੈ ਅਤੇ ਉਹ ਸਵੇਰੇ ਦੀ ਤਾਜ਼ੀ ਹਵਾ ਸਾਡੇ ਸਿਹਤ ਲਈ ਬਹੁਤ ਵਧੀਆ ਹੁੰਦੀ ਹੈ ਅਤੇ ਸੂਰਜ ਦੀ ਕਿਰਨਾਂ ਵੀ ਸਾਡੇ ਲਈ ਬਹੁਤ ਵਧੀਆ ਹੁੰਦੀਆਂ ਨੇ ਸਵੇਰ ਦੀ ਕਿਰਨਾਂ ਜਿਹੜੀ ਹੁੰਦੀਆਂ ਹੈ ਉਹਦੇ ਕਾਫ਼ੀ ਫ਼ਾਇਦੇ ਹੁੰਦੇ ਹਨ ਸਵੇਰੇ ਉੱਠਣ ਨਾਲ ਕਾਫ਼ੀ ਫ਼ਾਇਦੇ ਹੁੰਦੇ ਨੇ ਜਿੱਦਾਂ ਅਸੀਂ ਦੋੜ ਲਗਾਉਣ ਲਈ ਜਾਂਦੇ ਸੀ ਤਾਂ ਉੱਥੇ ਕਾਫ਼ੀ ਅਲੱਗ ਅਲੱਗ ਉਮਰ ਦੇ ਲੋਕ ਵੀ ਆਉਂਦੇ ਸੀ ਬੁੱਢੇ ਵੀ ਆਉਂਦੇ ਸੀ ਜਵਾਨ ਵੀ ਆਉਂਦੇ ਸੀ ਅਤੇ ਬੱਚੇ ਵੀ ਆਉਂਦੇ ਸੀ ਇਹ ਹੀ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਹਰ ਉਮਰ ਦੇ ਲੋਕ ਹੈ ਜਿਹੜੇ ਆਪਣੀ ਸਿਹਤ ਦਾ ਖਿਆਲ ਰੱਖਦੇ ਸਿਹਤ ਦਾ ਖਿਆਲ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਿਹਤ ਵਧੀਆ ਰਹੇਗੀ ਤਾਂ ਅਸੀਂ ਕੋਈ ਵੀ ਕੰਮ ਕਰ ਸਕਦੇ ਅਤੇ ਤੰਦਰੁਸਤੀ ਨਾਲ ਅਸੀਂ ਵਿਕਾਸ ਕਰ ਸਕਦੇ ਹਾਂ ਆਪਣਾ ਵੀ ਅਤੇ ਆਪਣੇ ਕਾਰੋਬਾਰ ਦਾ ਵੀ